ਹਾਂਜੀ ਜੇ ਗੱਲ ਕਰੀਏ ਸਕੂਲ ਦੇ ਵਿੱਚ ਲਾਈਬ੍ਰੇਰੀ ਦੀ ਹਾਂ ਮੈਂ ਸਾਡੇ ਸਕੂਲ ਦੇ ਵਿੱਚ ਲਾਈਬ੍ਰੇਰੀ ਹੈ ਉਸ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਕਿਤਾਬਾਂ ਹਨ ਕੰਪਿਊਟਰ ਦੇ ਰਿਲੇਟਡ ਵੀ ਹਨ ਪਿਛੋਕੜ ਦੇ ਰਿਲੇਟਡ ਵੀ ਹਨ ਜੋ ਕਿ ਇਤਿਹਾਸ ਹੁੰਦਾ ਹੈ ਅਤੇ ਆਉਣ ਵਾਲੇ ਟਾਈਮ ਲਈ ਜਿਵੇਂ ਸਾਇੰਸ ਦੀਆਂ ਕਿਤਾਬਾਂ ਸਾਇੰਸ ਦੀਆਂ ਕਿਤਾਬਾਂ ਪਰ ਮੈਨੂੰ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਪਸੰਦ ਸਾਡਾ ਇਤਿਹਾਸ ਹੈ ਜੋ ਕਿ ਮੈਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਉਸ ਨੂੰ ਮੈਂ ਬਹੁਤ ਜ਼ਿਆਦਾ ਆਕਰਸ਼ਿਤ ਹੁੰਦਾ ਹਾਂ ਉਸਦੇ ਵਿੱਚ ਕੀ ਹੈ ਮੈਂ ਮਸ ਮਹਾਰਾਜਾ ਰਣਜੀਤ ਸਿੰਘ ਉਹਨਾਂ ਦਾ ਜੋ ਪਿੱਛੇ ਉਹਨਾਂ ਦਾ ਰਾਜ ਸੀਗਾ ਉਸ ਬਾਰੇ ਮੈਂ ਬਹੁਤ ਜ਼ਿਆਦਾ ਧਿਆ ਧਿਆਨ ਨਾਲ ਪੜ੍ਹਿਆ ਹੈ ਹਰੀ ਸਿੰਘ ਨਲੂਆ ਜੋ ਕਿ ਸਾਡੇ ਬਹੁਤ ਹੀ ਯੋਧੇ ਹੋਏ ਹਨ ਜਰਨੈਲ ਹੋਏ ਹਨ ਉਹਨਾਂ ਬਾਰੇ ਮੈਂ ਬਹੁਤ ਚੰਗੀ ਤਰ੍ਹਾਂ ਪੜ੍ਹਿਆ ਹੈ ਹੋਰ ਕ ਹੋਰ ਸਾਡੇ ਜਿਹੜੇ ਸਾਡੇ ਗੁਰੂਆਂ ਦੀਆਂ ਚਾਰ ਸਾਹਿਬਜ਼ਾਦੇ ਦੀਆਂ ਕਿਤਾਬਾਂ ਪਈਆਂ ਹੁੰਦੀਆਂ ਸੀਗੀਆਂ ਧਰਮ ਦੇ ਰਿਲੇਟਡ ਉਹ ਕਿਤਾਬਾਂ ਪੜ੍ਹਨ ਦਾ ਮੈਂ ਬਹੁਤ ਸ਼ੌਕੀਨ ਹਾਂ ਇਸੇ ਤਰ੍ਹਾਂ ਸਾਡੇ ਜਦੋਂ ਸਾਡੇ ਬੱਚਿਆਂ ਦਾ ਰੁਝਾਨ ਨੂੰ ਦੇਖਦੇ ਹੋਏ ਜੇ ਅਸੀਂ ਲਾਈਬ੍ਰੇਰੀ ਦੇ ਵਿੱਚ ਜ਼ਿਆਦਾਤਰ ਕਿਤਾਬਾਂ ਦੀ ਗੱਲ ਕਰੀਏ ਤਾਂ ਉਹ ਇਸੇ ਇਤਿਹਾਸ ਦੇ ਰਿਲੇਟਡ ਜ਼ਿਆਦਾ ਸੀਗੀਆਂ ਹਨ ਅਤੇ ਬਾਕੀ ਕੰਪਿਊਟਰ ਇਹ ਇਹ ਵੀ ਸੀਗੀਆਂ ਪਰ ਉਹ ਉਹਨਾਂ ਦੇ ਮੁਕਾਬਲੇ ਦੇ ਵਿੱਚ ਘੱਟ ਸੀਗੀਆਂ ਕਿਉਂਕਿ ਸਕੂਲ ਦੇ ਵਿੱਚ ਲਾਈਬ੍ਰੇਰੀ ਦੇ ਵਿੱਚ ਕਿਤਾਬਾਂ ਉਹੀ ਜ਼ਿਆਦਾ ਰੱਖੀਆਂ ਜਾਂਦੀਆਂ ਹਨ ਜੋ ਕਿ ਬੱਚੇ ਜ਼ਿਆਦਾ ਡਿਮਾਂਡ ਕਰਦੇ ਹਨ ਬੱਚਿਆਂ ਦੀ ਡਿਮਾਂਡ ਨੂੰ ਦੇਖਦੇ ਹੋਏ ਇਹੀ ਇਤਿਹਾਸ ਦੀਆਂ ਕਿਤਾਬਾਂ ਜ਼ਿਆਦਾ ਰੱਖੀਆਂ ਗਈਆਂ ਕਿਉਂਕਿ ਸਾਡਾ ਸਕੂਲ ਵੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਨਾਂ 'ਤੇ ਹੈ ਇਸ ਇਸੇ ਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜੋ ਸਾਡੇ ਟਰੱਸਟੀ ਮੈਂਬਰ ਹੁੰਦੇ ਹਨ ਉਹ ਕਿਤਾਬਾਂ ਉਹਨਾਂ ਨੂੰ ਇਹੀ ਆਪਣੇ ਟੀਚਰਾਂ ਨੂੰ ਕਹਿੰਦੇ ਹੁੰਦੇ ਇਹੀ ਈਸ਼ੂ ਕਰ ਵੀ ਇੱਦਾਂ ਦੀਆਂ ਹੀ ਕਿਤਾਬਾਂ ਜ਼ਿਆਦਾ ਮਾਤਰਾ ਦੇ ਵਿੱਚ ਰੱਖੋ ਤਾਂ ਕਿ ਬੱਚਿਆਂ ਨੂੰ ਆਪਣੇ ਵੱਧ ਤੋਂ ਵੱਧ ਗਿਆਨ ਪ੍ਰਾਪਤ ਹੋ ਸਕੇ ਉਹਨਾਂ ਨੂੰ ਵੀ ਕੀ ਸਾਨੂੰ ਸਾਡਾ ਇਤਿਹਾਸ ਰਿਹਾ ਹੈ ਕਿੱਥੋਂ ਅਸੀਂ ਆਏ ਹਾਂ ਕਿੱਥੋਂ ਅਸੀਂ ਜੁੜਨਾ ਹੈ ਜਾ ਕੇ ਇਸੇ ਕਰਕੇ ਸਾਡੇ ਸਕੂਲ ਦੇ ਵਿੱਚ ਜ਼ਿਆਦਾਤਰ ਕਿਤਾਬਾਂ ਧਰਮ ਦੇ ਰਿਲੇਟਡ ਮੰਨੀਆਂ ਜਾਂਦੀਆਂ ਸਨ